ਮੈਂ ਕਿਸੇ ਖਾਣ ਬਣਾਉਣ ਦੇ ਮੁਕਾਬਲੇ ਵਿੱਚ ਭਾਗ ਨਹੀਂ ਲਿਆ ਵੈਸੇ ਕਿਸੇ ਖਾਣਾ ਛੋਟੇ ਮੋਟੇ ਜਿੱਦਾਂ ਘਰ 'ਚ ਬਣਾਉਣਾ ਹੈ ਘਰ ਦੇ ਵਿੱਚ ਹੀ ਮੁਕਾਬਲਾ ਕੀਤਾ ਹੈ ਅਤੇ ਇਹਨੂੰ ਕਿਸੇ ਯੂਟਿਊਬ 'ਤੇ ਪੋਸਟ ਨਹੀਂ ਕੀਤਾ ਅਤੇ ਮੈਂ ਜਿਹੜੀ ਆ ਦਾਲ ਬਣਾਈ ਸੀਗੀ ਦਾਲ ਇਹ ਦਾਲ ਜਿਹੜੀ ਸੀ ਅਰਹਰ ਦੀ ਦਾਲ ਸੀਗੀ ਬਣਾਈ ਹੋਈ ਅਤੇ ਉਹਦੇ ਵਿੱਚ ਕਟੋ ਇੱਕ ਕਟੋਰੀ ਅਰਹਰ ਲੈ ਲਈ ਨਮਕ ਪਾਇਆ ਚਮ ਹਲਦੀ ਸਾਬਤ ਲਾਲ ਮਿਰਚ ਬੜਾ ਚਮਚ ਜੀਰਾ ਹਿੰਗ ਹਰੀ ਮਿਰਚ ਕੱਟ ਕੇ ਪੰਜ ਛੇ ਬਰੀਕ ਕਟੀ ਲਸਣ ਦੀਆਂ ਕਲੀਆਂ ਅਦਰਕ ਟਮਾਟਰ ਬਰੀਕ ਛੋਟਾ ਛੋਟੇ ਚਮਚ ਲਾਲ ਮਿਰਚ ਪਾਊਡਰ ਬੜੇ ਚਮਚ ਬਰੀਕ ਕੱਟੀਆ ਧਨੀਆ ਛੋਟਾ ਪਿਆਜ ਬਰੀਕ ਕੱਪ ਪਾਣੀ ਸਭ ਅ ਸਵਾਦ ਅਨੁਸਾਰ ਪਾ ਲਿਆ ਅਤੇ ਇਹ ਪਾ ਕੇ ਜਦੋਂ ਮੈਂ ਬਣਾਇਆ ਅਤੇ ਇਹਨੂੰ ਦਾਲ ਤੜਕਾ ਆਪਣਾ ਕਿ ਵੀਹ ਕੁ ਮਿੰਟ ਦੇ ਵਿੱਚ ਪ ਵੀਹ ਮਿੰਟ ਪਹਿਲਾਂ ਭੇਅ ਕੇ ਰੱਖਿਆ ਲਸਣਾਂ ਨੂੰ ਛਿੱਲ ਕੇ ਸਭ ਕੁਛ ਵਿੱਚ ਪਾ ਕੇ ਪਾ ਕੇ ਸਭ ਕੁਛ ਬਣਾ ਲਿਆ ਜਦੋਂ ਇਹ ਬਣਿਆ ਅਤੇ ਮੈਂ ਇਹਨੂੰ ਜਦੋਂ ਬਣਾ ਕੇ ਆਪਣੀ ਵਾਈਫ ਦੇ ਮੂਹਰੇ ਪੇਸ਼ ਕੀਤਾ ਤਾਂ ਉਹ ਵੀ ਹੈਰਾਨ ਰਹਿ ਗਈ ਅਤੇ ਕੀ ਕਿਤਾਬਾਂ 'ਚੋਂ ਦੇਖ ਕੇ ਹੀ ਮੈਂ ਬਣਾਇਆ ਸੀਗਾ ਕੋਈ ਜ਼ਿਆਦਾ ਨਹੀਂ ਸੀਗਾ ਪਰ ਫਿਰ ਵੀ ਉਹ ਹੈਰਾਨ ਰਹਿ ਗਈ ਕਿ ਵੀ ਇੰਨਾ ਸਮਾਨ ਪਾ ਕੇ ਜਿੱਦਾਂ ਢਾਬੇ ਦੀ ਦਾਲ ਹੁੰਦੀ ਉੱਦਾਂ ਦੀ ਬਣੀ ਹੈ ਅਤੇ ਮੈਂ ਇਹਤੋਂ ਫਿਰ ਸੋਚਿਆ ਕਿ ਇਹ ਨੂੰ ਇੱਕ ਮੁਕਾਬਲੇ ਵਿੱਚ ਕਿਤੇ ਲੈ ਕੇ ਜਾਵਾਂ ਪਰ ਟਾਈਮ ਦੀ ਕਮੀ ਹੋਣ ਕਰਕੇ ਮੁਕਾਬਲੇ ਵਿੱਚ ਨਹੀਂ ਲੈ ਕੇ ਜਾ ਸਕਿਆ